ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਹਾਨੂੰ ਕਿੰਨੀ ਕੁ ਰੇਂਜ ਤੱਕ ਚੱਪਲ ਜਾਂ ਸੈਂਡਲ ਚਾਹੀਦੇ ਆ ਠੀਕ ਉਹ ਨਾ ਜੀ ਉਹ ਉਹਨਾਂ ਦੀ ਜਿਹੜੀ ਕੰਪਨੀ ਹੁੰਦੀ ਆ ਉਹ ਅਲੱਗ ਅਲੱਗ ਹੁੰਦੀਆਂ ਅਤੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਰੇਂਜ ਹੁੰਦੀ ਹੈ ਜਿਵੇਂ ਆਪਾਂ ਕਹਿ ਦਈਏ ਰਿਲੈਕਸੋ ਦੀ ਹੋ ਗਈ ਅਤੇ ਇੱਕ ਕੰਪਨੀ ਹੋ ਗਈ ਆਪਣੇ ਕੋਲੇ ਔਰਥੋ ਔਰਥੋ ਦੀ ਜਿਹੜੀ ਚੱਪਲ ਹੁੰਦੀ ਹੈ ਨਾ ਉਹ ਬਹੁਤ ਹੀ ਕੰਫਰਟੇਬਲ ਹੁੰਦੀ ਆ ਸੋਫਟ ਹੁੰਦੀ ਹੈ ਅਤੇ ਹੰਢਦੀ ਵੀ ਬਹੁਤ ਹੈ ਇਹਨਾਂ ਦੀ ਰੇਂਜ ਦੋ ਢਾਈ ਸੌ ਰੁਪਈਆ ਹੋਵੇਗੀ ਜੀ ਹਾਂਜੀ ਨਹੀਂ ਨਹੀਂ ਜੀ ਮਿਲ ਜਾਂਦੀਆਂ ਸੀ ਉਹ ਮੈਂ ਵੀ ਮੰਨਦੀ ਆ ਗੱਲ ਮਿਲ ਜਾਂਦੀਆ ਸੀ ਪਹਿਲਾਂ ਪਰ ਹੁਣ ਤੁਹਾਨੂੰ ਪਤਾ ਹੀ ਹੈ ਵੀ ਮਹਿੰਗਾਈ ਕਿੰਨੀ ਵੱਧ ਗਈ ਆ ਹਰੇਕ ਚੀਜ਼ ਦਾ ਰੇਟ ਵਧ ਗਿਆ ਹੈ ਨਾ ਤੁਸੀਂ ਆਪ ਪੜ੍ਹੇ ਲਿਖੇ ਹੋ ਤੁਸੀਂ ਬਾਹਰ ਅੰਦਰ ਜਾਂਦੇ ਹੋ ਤੁਹਾਨੂੰ ਪਤਾ ਹੀ ਹੋਵੇਗਾ ਹਾਂਜੀ ਹਾਂਜੀ ਪਤਾ ਕੀ ਹਾਂਜੀ ਹਾਂਜੀ ਹਾਂਜੀ ਸੈਂਡਲ ਦੀਆਂ ਵੱਖ ਵੱਖ ਕੰਪਨੀਆਂ ਹੁੰਦੀਆਂ ਉਹ ਵੈਸੇ ਤਾਂ ਸੈਂਡਲ ਪੰਜ ਸੌ ਤੋਂ ਸਟਾਰਟ ਹੋ ਜਾਂਦੇ ਐ ਪੰਜ ਸੌ ਤੋਂ ਲੈ ਕੇ ਤਿੰਨ ਹਜ਼ਾਰ ਤੱਕ ਦੇ ਸੈਂਡਲ ਵੀ ਮਿਲਦੇ ਆ ਉਹਨਾਂ ਦੀਆਂ ਕੰਪਨੀਆਂ ਅਲੱਗ ਅਲੱਗ ਹੁੰਦੀਆਂ ਅਤੇ ਉਹ ਕੰਪਨੀ ਦੇ ਅਕੋਰਡਿੰਗ ਉਹਨਾਂ ਦੀ ਰੇਂਜ ਹੁੰਦੀ ਹੈ ਜੀ ਹਾਂਜੀ ਅਤੇ ਇੱਕ ਵਾਰੀ ਤੁਹਾਨੂੰ ਮੇਰੀ ਸ਼ੌਪ 'ਤੇ ਆ ਕੇ ਵੀ ਅਲੱਗ ਅਲੱਗ ਡਿਜ਼ਾਇਨ ਦੇਖਣੇ ਪੈਣਗੇ ਅਤੇ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗੇ ਤੁਸੀਂ ਖਰੀਦ ਸਕੋ ਹੈ ਨਾ ਹਾਂਜੀ ਹਾਂਜੀ ਹਾਂਜੀ ਮੋਸਟ ਵੈਲਕਮ ਜੀ ਜ਼ਰੂਰ ਆਓ ਇੱਕ ਵਾਰ ਨਹੀਂ ਸੌ ਵਾਰ ਆਓ ਸਾਡੀ ਸ਼ੋਪ 'ਤੇ ਅਸੀਂ ਬੈਠੇ ਹੀ ਤੁਹਾਡੇ ਲਈ ਆ ਹਾਂਜੀ ਹਾਂਜੀ ਜ਼ਰੂਰ ਜੀ ਓਕੇ ਜੀ ਓਕੇ ਓਕੇ ਓਕੇ ਠੈਕ ਯੂ ਠੀਕ ਹੈ ਜੀ